ਪੰਜਾਬ ਬਾਰੇ ਜਿਹੜਾ ਆਮ ਲੋਕਾਂ ਦੇ ਵਿੱਚ ਧਾਰਨਾਵਾਂ ਹਨ ਇਹੋ ਧਾਰਨਾਵਾਂ ਨੇ ਸੈਲਾਨੀਆਂ ਨੂੰ ਇਹ ਨੇ ਇਹ ਨੇ ਕਿ ਉੱਥੇ ਜਿਵੇਂ ਕ ਪੰਜਾਬ ਦੇ ਵਿੱਚ ਬਹੁਤ ਸਾਰੇ ਘੱਲੂਘਾਰੇ ਹੋਏ ਨੇ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਨੇ ਪਰ ਲੋਕਾਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੈ ਇਤਿਹਾਸ ਦੇ ਬਾਰੇ ਜਾਣਕਾਰੀ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਇਸ ਚੀਜ਼ ਇਸ ਚੀਜ਼ ਬਾਰੇ ਪਤਾ ਨਹੀਂ ਹੈ ਕਿ ਕੀ ਚੰਗਾ ਹੋਇਆ ਹੈ ਅਤੇ ਕੀ ਮਾੜਾ ਹੋਇਆ ਹੈ ਅਤੇ ਦੂਜੇ ਪਾਸੇ ਜਿਹੜਾ ਪ ਵਾਤਾਵਰਣ ਸੰਬੰਧੀ ਮੁੱਦਾ ਹੈ ਉਸ ਦੇ ਵਿੱਚ ਸਾਨੂੰ ਪਾਣੀ ਨੂੰ ਪਾਣੀ ਜਿਹੜਾ ਸਾਡਾ ਹੈ ਲੋਕਾਂ ਨੂੰ ਇਹ ਲੱਗਦਾ ਹੈ ਕਿ ਦੂਸ਼ਿਤ ਹੋ ਚੁੱਕਿਆ ਹੈ ਬਟ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਜੋ ਫੈਕਟਰੀਆਂ ਦੇ ਨੇੜੇ ਤੇੜੇ ਥੋੜ੍ਹਾ ਜਗ੍ਹਾ ਹੈ ਉੱਥੇ ਕੁਛ ਹੱਦਾਂ ਦਾ ਪਾਣੀ ਦੂਸ਼ਿਤ ਹੋਇਆ ਹੈ ਬਾਕੀ ਜਗ੍ਹਾਵਾਂ 'ਤੇ ਇਹ ਸਾਰਾ ਪਾਣੀ ਦੂਸ਼ਿਤ ਨਹੀਂ ਹੋਇਆ ਹੈ